ਅਜਿਹੀਆਂ ਬਹੁਤ ਸਾਰੀਆਂ ਕੰਪਨੀਆਂ ਹਨ ਜੋ ਖੇਡਾਂ ਦੇ ਵਿਕਾਸ ਲਈ ਬਲ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖਿਡਾਰੀਆਂ ਦੀ ਬਹੁਤ ਜ਼ਿਆਦਾ ਮਦਦ ਕਰਦੀਆਂ ਹਨ ਕਿ ਮਤਲਬ ਕਿ ਬੱਚਿਆਂ ਨੂੰ ਜਾਂ ਖਿਡਾਰੀਆਂ ਨੂੰ ਖੇਡਣ ਦੇ ਮੁਕਾਬਲੇ ਸਮੇਂ ਕਿਸੇ ਵੀ ਚੀਜ਼ ਚੀਜ਼ ਦੀ ਜਾਂ ਸਮਾਨ ਦੀ ਜ਼ਰੂਰਤ ਹੁੰਦੀ ਹੈ ਉਹ ਇੱਕ ਕੰਪਨੀ ਜਾਂ ਹੋਰ ਬਹੁਤ ਸਾਰੀਆਂ ਅਜਿਹੀਆਂ ਕੰਪਨੀਆਂ ਜੋ ਕੰਪਨੀ ਵਲੋਂ ਹੀ ਦਿੱਤੀਆਂ ਜਾਂਦੀਆਂ ਹਨ ਖਿਡਾਰੀਆਂ ਦੀਆਂ ਮਤਲਬ ਕਿ ਕਿੱਟਾਂ ਵਗੈਰਾ ਕਿੱਟਾਂ ਉੱਪਰ ਨਾਂ ਲਿੱਖ ਕੇ ਜਾਂ ਇੱਕੋ ਜਿਹੀਆਂ ਕਿੱਟਾਂ ਮਤਲਬ ਕਿ ਜੋ ਉਹ ਪਹਿਨਦੇ ਹਨ ਜਾਂ ਕੋ ਕੋਈ ਵੀ ਗੇਮ ਹੁੰਦੀ ਹੈ ਹੈ ਨਾ ਜੋ ਵੀ ਖਿਡਾਰੀ ਖੇਡਦੇ ਹਨ ਜਿਵੇਂ ਕਿ ਫੁਟਬੋਲ ਬੈਡਮਿੰਟਨ ਕ੍ਰਿਕੇਟ ਉਹ ਸਾ ਉਸਦਾ ਸਾਰਾ ਸਮਾਨ ਹੀ ਮਤਲਬ ਕਿ ਕੰਪਨੀ ਵਲੋਂ ਹੀ ਪ੍ਰਵਾਇਡ ਕੀਤਾ ਜਾਂਦਾ ਹੈ ਕੰਪਨੀ ਖਿਡਾਰੀਆਂ ਦੇ ਖੇਡਾਂ ਵਿੱਚ ਬਹੁਤ ਹੀ ਸਹਾਇਤਾ ਕਰਦੀਆਂ ਹਨ ਜਿਵੇਂ ਕਿ ਇੱਕ ਅਜਿਹੀ ਕੰਪਨੀ ਹੈ ਬੀ ਆਈ ਆਈ ਟੀ ਜੋ ਕਿ ਕੰਪਨੀ ਜੋ ਕੰਪਨੀ ਮਤਲਬ ਕਿ ਬੱਚਿਆਂ ਨੂੰ ਜਾਂ ਖਿਡਾਰੀਆਂ ਨੂੰ ਜੋ ਮੁਕਾਬਲਿਆਂ ਵਿੱਚ ਉਹਨਾਂ ਨੂੰ ਕਿਸੇ ਵੀ ਚੀਜ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਪ੍ਰੋਵਾਇਡ ਕਰਦੀ ਹੈ ਅਤੇ ਜ ਕੋਈ ਵੀ ਕੰਪਨੀ ਅੰਤਰ ਰਾਸ਼ਟਰੀ ਪੱਧਰ 'ਤੇ ਜਦੋਂ ਵੀ ਮੁਕਾਬਲੇ ਹੁੰਦੇ ਹਨ ਮਤਲਬ ਕਿ ਜਾਂ ਖੇਡਾਂ ਹੁੰਦੀਆਂ ਹਨ ਤਾਂ ਉੱਥੋਂ ਦੇ ਜ ਜਿਹੜਾ ਵੀ ਤਿਆਰੀ ਹੁੰਦੀ ਹੈ ਉਹ ਕੰਪਨੀ ਵਲੋਂ ਹੀ ਕੀਤੀ ਜਾਂਦੀ ਹੈ ਜਿਵੇਂ ਕਿ ਉੱਥੇ ਲਾਈਟਿੰਗ ਜਾਂ ਕੋਈ ਵੀ ਖੇਡਾਂ ਰਿਸ਼ਵੇਸ਼ਮੈਂਟ ਜਾਂ ਹੋਰ ਵੀ ਕੋਈ ਵੀ ਬਹੁਤ ਸਾਰੀਆਂ ਤਿਆਰੀਆਂ ਹੁੰਦੀਆਂ ਹਨ ਜੋ ਖੇਡਾਂ ਦੇ ਮੁਕਾਬਲੇ ਸਮੇਂ ਕੀਤੀਆਂ ਜਾਂਦੀਆਂ ਹਨ ਉਹ ਕੰਪਨੀ ਵਲੋਂ ਹੀ ਕੀਤੀ ਜਾਂਦੀ ਹੈ ਅਤੇ ਸਾਰਾ ਹੀ ਸਾਰਾ ਕੁਛ ਹੀ ਕੰਪਨੀ ਵਲੋਂ ਤਿਆਰ ਕੀਤਾ ਜਾਂਦਾ ਹੈ ਬੱਚਿਆਂ ਦੀ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਜ਼ਰੂਰਤ ਕੰਪਨੀ ਪ੍ਰਵਾਇਡ ਕੀਤੀ ਜਾਂਦੀ ਹੈ ਇੱਕ ਕੰਪਨੀ ਬੀ ਆਈ ਆਈ ਟੀ ਹੈ ਅਤੇ ਅਜਿਹੀਆਂ ਬਹੁਤ ਸਾਰੀਆਂ ਕੰਪਨੀਆਂ ਹਨ ਜੋ ਕਿ ਬੱਚਿਆਂ ਨੂੰ ਖੇਡਣ ਲਈ ਉਤਸ਼ਾਹਿਤ ਅਤੇ ਉਹਨਾਂ ਦੀ ਮਾ ਮਦਦ ਕਰਦੀਆਂ ਹਨ ਅਤੇ ਅੰਤਰ ਰਾਸ਼ਟਰੀ ਪ ਖੇਡਾਂ ਦੇ ਪੱਧਰ 'ਤੇ ਬਹੁਤ ਸਾਰੀ ਸਹਾਇਤਾ ਕਰਦੀਆਂ